ਪੰਜਾਬ ਦੀਆਂ ਸੜਕਾਂ ਬਾਰੇ ਪੁੱਛਿਆ ਗਿਆ ਹਾਲਾਤ ਪੁੱਛੇ ਗਏ ਨੇ ਤਾਂ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਨੇ ਹਾਂ ਬਹੁਤ ਵਧੀਆ ਨੇ ਅਗਰ ਮੈਂ ਕਿਸੇ ਹੋਰ ਸਟੇਟ ਦੀ ਗੱਲ ਕਰਾਂ ਅਗਰ ਮੈਂ ਪੰਜਾਬ ਦਾ ਵਾਸੀ ਹਾਂ ਤਾਂ ਮੈਂ ਨਾਲ ਦੀਆਂ ਸਟੇਟਾਂ ਦੀ ਗੱਲ ਕਰਾਂ ਤਾਂ ਉਹਨਾਂ ਨਾਲੋਂ ਕਈ ਗੁਣਾ ਪੰਜਾਬ ਦੀਆਂ ਸੜਕਾਂ ਚੰਗੀਆਂ ਨੇ ਸ਼ਹਿਰੀ ਸੜਕਾਂ ਨਗਰ ਨਿਗਮ ਦੇ ਅੰਡਰ ਨੇ ਬਟ ਬਹੁਤ ਸੋਹਣੀਆਂ ਨੇ ਪਰ ਜੇ ਮੈਂ ਸਾਡੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰਾਂ ਪਿੰਡਾਂ ਦੀਆਂ ਸੜਕਾਂ ਵੀ ਇੰਨੀਆਂ ਸ਼ ਸੋਹਣੀਆਂ ਬਣ ਚੁੱਕੀਆਂ ਨੇ ਕਿ ਸਾਨੂੰ ਚਲਦੇ ਫਿਰਦੇ ਇਹਨਾਂ ਚੀਜ਼ਾਂ ਦਾ ਪਤਾ ਲੱਗ ਹੀ ਜਾਂਦਾ ਹੈ ਕਿੱਥੇ ਝਟਕ ਝਟਕ ਕੇ ਜਾਈਦਾ ਹੁੰਦਾ ਸੀ ਕਹਿ ਲਓ ਕਿ ਲੋਕੀ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਖਾਧਾ ਪੀਤਾ ਪਚਦਾ ਨਹੀਂ ਕਿਸੇ ਰੋਡਵੇਜ਼ ਦੀ ਬੱਸ ਬਹਿ ਜਾਓ ਅਤੇ ਤੁਹਾਨੂੰ ਪਤਾ ਲੱਗ ਜੇਗਾ ਬਟ ਹੁਣ ਤਾਂ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ ਕਾਰਪੋਰੇਸ਼ਨ ਦਾ ਵੀ ਬਹੁਤ ਵਧੀਆ ਕੰਮ ਹੈ ਪੰਜਾਬ ਸਰਕਾਰ ਦਾ ਵੀ ਬਹੁਤ ਸੋਹਣਾ ਕੰਮ ਹੈ ਅਤੇ ਇਸ ਕਰਕੇ ਅਗਰ ਤੁਸੀਂ ਕਿਸੇ ਚੀਜ਼ ਦੀ ਇ ਇਹਦੇ ਬਾਰੇ ਪਤਾ ਵੀ ਕਰਨਾ ਤਾਂ ਸੜਕ ਵਿਭਾਗ ਦੇ ਅਦਾਰਿਆਂ 'ਤੇ ਜਾ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਹੈ ਗਵਰਮੈਂਟ ਦੇ ਜਿਹੜੇ ਨਿਯਮ ਨੇ ਉਹ ਪੜ੍ਹੇ ਜਾ ਸਕਦੇ ਨੇ ਉੱਥੇ ਰਹਿ ਗਈ ਗੱਲ ਅਸੀਂ ਕਹੀਏ ਕਿ ਸੜਕਾਂ ਦੇ ਲਈ ਗੋਰਮਿੰਟ ਜਿਹੜੇ ਕੰਟਰੈਕਟ ਕਰਦੀ ਹੈ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਵੀ ਵਚਨਬੱਧ ਹੈ ਸਰਕਾਰ ਦੇ ਵਚਨਬੱਧ ਯਾਂ ਕਾਰਪੋਰੇਸ਼ਨ ਦੇ ਕੰਟਰੈਕਟਰਾਂ ਨਾਲ ਵਚਨਬੱਧ ਹੋਣ ਕਰਕੇ ਉਹਨਾਂ ਦੇ ਉੱਤੇ ਸਖਤੀ ਵੀ ਕੀਤੀ ਜਾਂਦੀ ਜਿਹਦੀ ਵਜ੍ਹਾ ਕਰਕੇ ਰੋਡਸ ਦੇ ਸਾਰੇ ਜਿੰਨੇ ਵੀ ਚਾਹੇ ਉਹ ਪੇਂਡੂ ਏਰੀਆ ਦੀਆਂ ਹੁੰਦੀਆਂ ਨੇ ਚਾਹੇ ਉਹ ਸ਼ਹਿਰੀ ਏਰੀਏ ਦੀ ਹੁੰਦੀਆਂ ਨੇ ਉਹਨਾਂ ਦੇ ਹਾਲਾਤ ਕਾਫੀ ਚੰਗੇ ਨੇ ਪੰਜਾਬ ਦੀਆਂ ਰੋਡਸ ਬੈਟਰ ਦੈਨ ਦਿੱਲੀ ਬੈਟਰ ਦੈਨ ਹਰਿਆਣਾ ਮਤਲਬ ਅਸੀਂ ਸੀਨਾ ਚੌੜਾ ਕਹਿ ਸਕ ਕਰਕੇ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਬਹੁਤ ਵਧੀਆ ਅਤੇ ਪਿੰਡਾਂ ਦੀਆਂ ਸ਼ਹਿਰਾਂ ਤੋਂ ਵੀ ਵਧੀਆ ਦਿੱਤੀਆਂ ਗਈਆਂ ਨੇ